ਸਤਿ ਸ਼੍ਰੀ ਅਕਾਲ ਜੀ ਤਨਵੀਰ ਜੀ ਹੋਰ ਕੀ ਹਾਲ ਹੈ ਪਰਿਵਾਰ ਸਭ ਠੀਕ ਠਾਕ ਹੈ ਇੱਕ ਕੱਲ੍ਹ ਤੁਸੀਂ ਗਏ ਸੀ ਲੱਕੀ ਢਾਬੇ 'ਤੇ ਖਾਣਾ ਖਾਣ ਲਈ ਉਹਨਾਂ ਦੀ ਸਰਵਿਸ ਕਿਸ ਤਰ੍ਹਾਂ ਦੀ ਲੱਗੀ ਰੋਟੀ ਪਾਣੀ ਕਿਸ ਤਰ੍ਹਾਂ ਦਾ ਹੈ ਪਾਰਕਿੰਗ ਦੀ ਸੁਵਿਧਾ ਕਿਸ ਤਰ੍ਹਾਂ ਦੀ ਹੈ ਸਬਜ਼ੀਆਂ ਖਾਣ ਨੂੰ ਤਾਜ਼ੀਆਂ ਦਿੰਦੇ ਹਨ ਸਰਵਿਸ ਉਹਨਾਂ ਦੀ ਕਿਸ ਤਰ੍ਹਾਂ ਦੀ ਲੱਗੀ ਕਿਉਂਕਿ ਮੈਂ ਮੋਬਾਇਲ 'ਤੇ ਚੈੱਕ ਕੀਤਾ ਸੀ ਉਹਨਾਂ ਦੀ ਰੇਟਿੰਗ ਚਾਰ ਪੁਆਇੰਟ ਪੰਜ ਸੀ ਅਤੇ ਮੈਂ ਪਰਿਵਾਰ ਨਾਲ ਜਾਣਾ ਚਾਹੁੰਦਾ ਹਾਂ ਕੋਈ ਮੈਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਮੈਨੂੰ ਦੱਸਿਓ ਧੰਨਵਾਦ